ਨੌਂ ਲੱਖ ਨੜਿਨਵੇਂ ਹਜ਼ਾਰ ਨੌਂ ਸੌ ਨੜਿਨਵੇਂ ਅੱਠ ਲੱਖ ਅਠਾਸੀ ਹਜ਼ਾਰ ਅੱਠ ਸੌ ਅਠਾਸੀ ਸੱਤ ਲੱਖ ਸਤੱਤਰ ਹਜ਼ਾਰ ਸੱਤ ਸੌ ਸਤੱਤਰ ਛੇ ਲੱਖ ਛਿਆਹਠ ਹਜ਼ਾਰ ਛੇ ਸੌ ਛਿਆਹਠ ਪੰਜ ਲੱਖ ਪਚਵੰਜਾ ਹਜ਼ਾਰ ਪੰਜ ਸੌ ਪਚਵੰਜਾ